ਹੈਲੋ ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਹੈ ਬਸ ਵਧੀਆ ਠੀਕ ਠਾਕ ਹੈ ਹਾਂਜੀ ਅੱਛਾ ਅਡਮੀਸ਼ਨ ਨਿਊ ਅਡਮੀਸ਼ਨ ਹਾਂ ਹਾਂ ਅੱਛਾ ਠੀਕ ਹੈ ਸਾਡਾ ਹਾਂ ਅੱਛਾ ਠੀਕ ਹੈ ਮੈਂ ਵੀ ਵੈਸੈ ਨਾ ਪਿੱਛੇ ਜਿਹੇ ਸਕੂਲ ਦਾ ਪਤਾ ਕੀਤਾ ਸੀਗਾ ਸਾਡੇ ਆਪਣੇ ਛੋਟੇ ਬੱਚੇ ਨੂੰ ਪਾਉਣਾ ਸੀਗਾ ਦੋ ਤਿੰਨ ਮੈਂ ਤਿੰਨ ਚਾਰ ਸਕੂਲ 'ਚ ਗਈ ਹਾਂ ਜਿਵੇਂ ਕੇ ਡੀ ਇੰਟਰਨੈਸ਼ਨਲ ਕਾਫੀ ਵਧੀਆ ਲੱਗਾ ਵੈਸੇ ਮੈਨੂੰ ਸਕੂਲ ਇੱਕ ਜਿਸ ਦਾ ਮੈਂ ਨਾਮ ਕਾਫੀ ਸੁਣਿਆ ਹੋਇਆ ਸੀਗਾ ਕਿਡਜ਼ੀ ਸਕੂਲ ਵੀ ਗਈ ਸਾਂ ਪ੍ਰਿੰਸੀਪਲ ਨਾਲ ਪ੍ਰਿੰਸੀਪਲ ਬੜੇ ਵਧੀਆ ਢੰਗ ਨਾਲ ਮਿਲੇ ਮੇਰੇ ਨਾਲ ਇਸ ਤੋਂ ਇਲਾਵਾ ਮੈਂ ਅਲੈਗਜੈਂਡਰਾ

ਐਂਜਲ ਪੈਰਾਡਾਈਜ਼ ਹਾਂ ਹਾਂ ਵਧੀਆ ਸਕੂਲ ਹੈ ਚਰ ਹਾਂ ਹਾਂ ਹਾਂ ਉਹ ਛੋਟੇ ਬੱਚਿਆਂ ਦਾ ਹੀ ਆ ਨਾ ਵੈਸੇ ਹਾਂ ਹਾਂ ਛੋਟੇ ਜੂਨੀਅਰ ਕਲਾਸਿਸ ਤੱਕ ਹੀ ਆ ਜੂਨੀਅਰ ਕਲਾਸਿਸ ਤੱਕ ਹੈ ਕਾਫੀ ਬੱਚੇ ਵਧਾ ਤਾ ਅੱਛਾ ਬੱਚਿਆਂ ਨੇ ਬਾਅਦ 'ਚ ਹਾਂ ਪਲੇਅ ਵੇ ਮੈਥਡ ਨਾਲ ਕਰਾਉਂਦੇ ਨੇ ਪਲੇਅ ਵੇ ਮੈਥਡ ਹੈ ਉੱਥੇ ਹਾਂ ਹਾਂ ਜਲ ਪੈਰਾਡਾਈਜ਼ ਹਾਂ ਹਾਂ ਬੈਸਟ ਸਕੂਲ ਬੈਸਟ ਸਕੂਲ ਹੈ ਹਾਂ ਹਾਂ

ਹਾਂ ਹਾਂ ਨਹੀਂ ਸਕੂਲ ਵਧੀਆ ਹਾਂ ਕਾਫੀ ਤਰਨ ਤਾਰਨ 'ਚ ਸਕੂਲ ਹੈਗੇ ਕਾਫੀ ਹੋ ਗਏ ਨੇ ਪਰ ਥੋੜ੍ਹਾ ਜਿਹਾ ਇਹ ਵੇਖਣਾ ਪੈਂਦਾ ਜਦੋਂ ਜਾਈਏ ਨਾ ਫਿਰ ਪਤਾ ਲੱਗ ਜਾਂਦਾ ਕਿ ਸਕੂਲ ਆਹ ਵਾਲਾ ਵਧੀਆ ਹੈ ਥੋੜ੍ਹਾ ਹਾਂ ਹਾਂ ਹਾਂ ਹਾਂ ਚਲ ਜਾਂਗੇ ਮੈਂ ਵੀ ਹਾਂ ਵਿਜ਼ਿਟ ਕਰਾਂਗੇ ਨਾ ਆਪਾਂ ਉੱਥੇ ਵੀ ਓਕੇ